ਹਾਂਜੀ ਪੰਜਾਬ ਵਿੱਚ ਵੈਸੇ ਤਾਂ ਬਹੁਤ ਜ਼ਿਆਦਾ ਹੋਸਪੀਟਲਸ ਨੇ ਜਿਵੇਂ ਮੇਨ ਨੇ ਆਪਾਂ ਕਹਿ ਦਿਉ ਕਿ ਜਿਵੇਂ ਅਮਰ ਹੋਸਪੀਟਲ ਹੋ ਗਿਆ ਕੋਲੰਬ ਏਸ਼ੀਆ ਹੋ ਗਿਆ ਰਜਿੰਦਰਾ ਹੋਸਪੀਟਲ ਡੀ ਐੱਮ ਸੀ ਲੁਧਿਆਣਾ ਪੀ ਜੀ ਆਈ ਚੰਡੀਗੜ ਅਤੇ ਪੀ ਜੀ ਆਈ ਸੰਗਰੂਰ ਵੀ ਹੈ ਏਮਸ ਹੋਸਪੀਟਲ ਬਠਿੰਡੇ ਵੀ ਹੈ ਕਿਉਂਕਿ ਜਿਹੜੇ ਸਰਕਾਰੀ ਹੋਸਪੀਟਲਸ ਨੇ ਜਿਵੇਂ ਏਮਸ ਹੋ ਗਿਆ ਪੀ ਜੀ ਆਈ ਹੋ ਗਿਆ ਠੀਕ ਹੈ ਇਹਨਾਂ ਸ ਹੋਸਪੀਟਲਾਂ ਦੇ ਵਿੱਚ ਕੀ ਹੁੰਦਾ ਇੱਕ ਤਾਂ ਫੀਸ ਚਾਰਜਿਸ ਬਹੁਤ ਘੱਟ ਹੁੰਦੇ ਨੇ ਅਤੇ ਮਤਲਬ ਜਿਹੜਾ ਮਰੀਜ਼ ਦਾ ਇਲਾਜ ਹੈ ਉਹ ਬਹੁਤ ਵਧੀਆ ਹੋ ਜਾਂਦਾ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਡੋਕਟਰ ਬਹੁਤ ਅੱਛੇ ਹੁੰਦੇ ਨੇ ਗੋਰਮਿੰਟਸ ਹੋਸਪੀਟਲਸ ਹੁੰਦੇ ਨੇ ਜਿਵੇਂ ਰਾਜਿੰਦਰਾ ਹੋਸਪੀਟਲ ਹੋ ਗਿਆ ਇੱਥੇ ਗੋਰਮਿੰਟ ਉਹ ਹੁੰਦੇ ਨੇ ਡੋਕਟਰਸ ਹੁੰਦੇ ਨੇ ਠੀਕ ਹੈ ਇਹ ਸਾਡਾ ਇਲਾਜ ਬਹੁਤ ਅੱਛੀ ਤਰ੍ਹਾਂ ਕਰਦੇ ਨੇ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਕੋਈ ਲਾਲਚ ਨਾ ਹੋ ਕੇ ਸਾਨੂੰ ਬਹੁਤ ਅੱਛੀ ਤਰ੍ਹਾਂ ਗਾਈਡ ਕਰਦੇ ਨੇ ਤਾਂ ਜਿਹੜੇ ਪੇਸ਼ੈਟਸ ਹੁੰਦੇ ਨੇ ਉਹਨਾਂ ਨੂੰ ਗਲਤ ਚੱਕਰਾਂ 'ਚ ਨਹੀਂ ਪਾਉਂਦੇ ਉਹਨਾਂ ਨਾਲ ਉਹਨਾਂ ਦੀ ਬਿਮਾਰੀ ਦਾ ਇਲਾਜ ਜਲਦੀ ਤੋਂ ਜਲਦੀ ਹੋ ਜਾਂਦਾ ਹੈਗਾ